ਗਾਇਕੀ ਵਿੱਚ ਜਾਂ ਸੰਗੀਤ ਵਿੱਚ ਰਾਗਾਂ ਦਾ ਬਹੁਤ ਮਹੱਤਵ ਹੈ ਸੰਗੀਤ ਜਾਂ ਗਾਇਕੀ ਵਿੱਚ ਕੁਝ ਰਾਗ ਜਿਵੇਂ ਕਿ ਰਾਗ ਕਾਫ਼ੀ ਰਾਗ ਅਹੀਰ ਬੈਰਵ ਰਾਗ ਮਲਹਾਰ ਰਾਗ ਬਿਲਾ ਸੱਖਣੀ ਤੋੜੀ ਰਾਗ ਝੰਝੋਟੀ ਰਾਗ ਰਾਮਦਾਸੀ ਮਲਹਾਰ ਅਤੇ ਰਾਗ ਅਭੋਗੀ ਤਾਲ ਇੱਕ ਲੈਅ ਬੱਧ ਚੀਜ਼ ਹੈ ਜੋ ਕਿਸੇ ਸੰਗੀਤ ਜਾਂ ਗਾਇਕੀ ਨੂੰ ਧੁਨ ਵਿੱਚ ਰੱਖਦਾ ਹੈ ਰਾਗ ਕਾਫ਼ੀ ਇੱਕ ਸੰਪੂਰਨ ਰਾਗ ਹੈ ਜੋ ਵਧਦੇ ਘੱਟਦੇ ਦੋਵੇਂ ਰੂਪ ਨੂੰ ਵਰਤਦੀ ਹੈ ਰਾਗ ਅਹੀਰ ਬੈਰਵ ਦੋ ਰਾਗਾਂ 'ਚ ਮਿਲਾ ਕੇ ਬਣਾਇਆ ਹੈ ਅਹੀਰ ਅਤੇ ਬੈਰਵ ਭੈਰਵ ਰਾਗ ਮਲਹਾਰ ਬਰਸਾਤਾਂ ਨਾਲ ਸੰਬੰਧਿਤ ਹੈ ਰਾਗ ਝੰਝੋਟੀ ਹਲਕਾ ਰਾਗ ਹੈ ਰਾਗ ਰਾਮਦਾਸੀ ਮਲਹਾਰ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਬਣਿਆ ਸੀ ਰਾਗ ਅਭੋਗੀ ਦੱਖਣੀ ਭਾਰਤ ਦਾ ਸੰਗੀਤ ਹੈ ਰਾਗ ਭਾਰਤੀ ਕਲਾਸੀਕਲ ਸੰਗੀਤ ਦਾ ਅਟੁੱਟ ਹਿੱਸਾ ਹਨ ਇਹ ਸਾਡੀ ਸੰਸਕ੍ਰਿਤੀ ਨੂੰ ਸਾਂਭਦੇ ਹਨ ਅਤੇ ਸੰਸਕ੍ਰਿਤੀ ਦਾ ਪ੍ਰਦਰਸ਼ਨ ਕਰਦੇ ਹਨ ਇਹ ਭਾਰਤ ਵਿੱਚ ਵੱਖਰੇ ਧਰਮਾਂ ਜਿਵੇਂ ਹਿੰਦੂ ਸਿੱਖ ਜੈਨੀ ਸੂਫ਼ੀ ਸਾਰਿਆਂ ਨੂੰ ਹੀ ਪ੍ਰਦਰਸ਼ਿਤ ਕਰਦੇ ਹਨ ਇਹ ਰਾਗ ਪੂਜਾ ਪਾਠ ਦਾ ਵੀ ਅਟੁੱਟ ਅੰਗ ਹਨ ਰਾਗ ਸੰਗੀਤ ਸੁਣਨ ਵਾਲੇ ਨੂੰ ਰੱਬ ਨਾਲ ਵੀ ਜੋੜਦੇ ਹਨ ਇਹ ਰਾਗ ਸੁਣਨ ਵਾਲੇ ਦੇ ਅੰਤਰ ਮਨ ਨੂੰ ਰੱਬ ਨਾਲ ਜੋੜ ਕੇ ਆਤਮਿਕ ਅਨੰਦ ਦਿੰਦੇ ਹਨ ਅੱਜ ਕੱਲ੍ਹ ਦੇ ਗਾਣੇ ਵੀ ਪੁਰਾਣੇ ਰਾਗਾਂ 'ਤੇ ਅਧਾਰਿਤ ਹਨ ਬਾਲੀਵੁੱਡ ਅਤੇ ਭਾਰਤੀ ਫੋਕ ਸੰਗੀਤ ਵੀ ਰਾਗਾਂ 'ਤੇ ਹੀ ਅਧਾਰਿਤ ਹੁੰਦਾ ਹੈ